ਸਤਿ ਸ਼੍ਰੀ ਅਕਾਲ ਮੈਂ ਕੋਮਲ ਬੋਲਦੀ ਪਈਂ ਹਾਂ ਮੈਂ ਤੁਹਾਨੂੰ ਪੁੱਛਣਾ ਸੀ ਸਾਡੇ ਘਰ ਫੰਕਸ਼ਨ ਸੀਗਾ ਅਤੇ ਮੈਂ ਉਹਦੇ ਲਈ ਸਬਜ਼ੀਆਂ ਲੈਣੀਆਂ ਸੀਗੀਆਂ ਅਤੇ ਸਬਜ਼ੀਆਂ ਵਧੀਆ ਅਤੇ ਸਸਤੀਆਂ ਹੋਣੀਆਂ ਚਾਹੀਦੀਆਂ ਕੀ ਕੀ ਕੋਲ ਤੁਹਾਡੇ ਕੋਲ ਸਬਜ਼ੀਆਂ ਨੇ ਤੁਹਾਡੇ ਕੋਲ ਗੋਭੀ ਉਹਦਾ ਪ੍ਰਾਈਜ਼ ਕਿੰਨਾ ਕੁ ਹੈ ਅਤੇ ਟਮਾਟਰ ਮਿਰਚਾਂ ਹੋਰ ਇਸ ਤੋਂ ਇਲਾਵਾ ਹੋਰ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਹੋਣਗੀਆਂ ਹਾਂਜੀ ਹਾਂਜੀ ਹਾਂਜੀ ਠੀਕ ਹੈ ਅਤੇ ਹੋਰ ਤੁਹਾਡੇ ਤੋਂ ਮਸ਼ਰੂਮ ਹੋਣਗੇ ਅਤੇ ਫਿਰ ਤੁਹਾਡੇ ਤੋਂ ਹੋਰ ਭਿੰਡੀਆਂ ਹੋਣਗੀਆਂ ਠੀਕ ਹੈ ਅਤੇ ਜਿਹੜੀਆਂ ਫਲੀਆਂ ਹੁੰਦੀਆਂ ਉਹ ਹੈਗੀਆਂ ਫਿਰ ਤੁਸੀਂ ਔਡਰ ਲਿਖ ਲਓ ਦਸ ਕਿੱਲੋ ਆਲੂ ਕਰ ਦਿਓ ਅਤੇ ਚਾਰ ਕਿੱਲੋ ਪਿਆਜ਼ ਕਰ ਦਿਓ ਅਤੇ ਇਸ ਜਿੰਨੀਆਂ ਵੀ ਸਬਜ਼ੀਆਂ ਨੇ ਉਹ ਸਾਰੀਆਂ ਫਰੈਸ਼ ਹੋਣੀਆਂ ਚਾਹੀਦੀਆਂ ਨੇ ਅਤੇ ਵਧੀਆ ਹੋਣੀਆਂ ਚਾਹੀਦੀਆਂ ਨੇ ਹਾਂਜੀ ਠੀਕ ਥੈਂਕਯੂ